ਸਰ ਮੈਂ ਰਾਜਕੁਮਾਰ ਪਿੰਡ ਰੈਲਮਾਜਰਾ ਐੱਸ ਬੀ ਐੱਸ ਨਗਰ ਤੋਂ ਬੋਲ ਰਿਹਾ ਹਾਂ ਮੈਂ ਨਵਾਂਸ਼ਹਿਰ ਟੈਕਸੀ ਸਟੈਂਡ ਤੋਂ ਇੱਕ ਕੈਬ ਬੁੱਕ ਕੀਤੀ ਸੀ ਜੋ ਕਿ ਮੈਨੂੰ ਪ੍ਰਾਪਤ ਨਹੀਂ ਹੋਈ ਸਰ ਮੈਂ ਕਈ ਵਾਰ ਉਸ ਡਰਾਈਵਰ ਨੂੰ ਕੌਲ ਕੀਤੀ ਪਰ ਉਹਨਾਂ ਨੇ ਮੇਰੀ ਕੌਲ ਦਾ ਜਵਾਬ ਨਹੀਂ ਦਿੱਤਾ ਉਸ ਤੋਂ ਬਾਅਦ ਮੈਂ ਸੱਤ ਅੱਠ ਵਾਰ ਵੱਟਸਐਪ 'ਤੇ ਮੈਸੇਜ ਕੀਤਾ ਪਰ ਫਿਰ ਵੀ ਉਸ ਮੈਸੇਜ ਦਾ ਰਿਪਲਾਈ ਨਹੀਂ ਆਇਆ ਉਸਦੇ ਸੱ ਨੌ ਦਸ ਮਿੰਟ ਬਾਅਦ ਉਹਨਾਂ ਦੀ ਕੌਲ ਆਈ ਕਿ ਮੈਂ ਆ ਰਿਹਾ ਹਾਂ ਪਰ ਉਹਨਾਂ ਨੇ ਮੈਨੂੰ ਲਾਰੇ ਵਿੱਚ ਰੱਖਿਆ ਸਰ ਉਸ ਤੋਂ ਬਾਅਦ ਉਹ ਕਹਿੰਦੇ ਕਿ ਮੈਂ ਆ ਰਿਹਾ ਹਾਂ ਪਰ ਫਿਰ ਵੀ ਉਹ ਪਹੁੰਚੇ ਨਹੀਂ ਸਰ ਇਸ ਕਾਰਨ ਮੇਰਾ ਟਾਈਮ ਬਹੁਤ ਖਰਾਬ ਹੋਇਆ ਹੈ ਮੈਂ ਜੰਮੂ ਪਹੁੰਚਣਾ ਸੀ ਪਰ ਉੱਥੇ ਪਹੁੰਚ ਨਹੀਂ ਸਕਿਆ ਕਿਰਪਾ ਕਰਕੇ ਮੇਰੀ ਬੁਕਿੰਗ ਕੈਂਸਲ ਕੀਤੀ ਜਾਵੇ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹੋਵਾਂਗਾ ਸੋ ਸਰ ਮੈਂ ਤੁਹਾਨੂੰ ਇੱਕ ਸੁਝਾਅ ਦੇਣਾ ਚਾਹੁੰਦਾ ਹਾਂ ਕਿ ਅੱਗੇ ਤੋਂ ਕਦੇ ਵੀ ਕਿਸੇ ਨਾਲ਼ ਇਹੋ ਜਿਹਾ ਵਰਤਾਵ ਨਾ ਹੋਵੇ ਸੋ ਮੇਰੀ ਇਸ ਅਪੀਲ ਨੂੰ ਬਹੁਤ ਹੀ ਧਿਆਨ ਨਾਲ ਰੱਖਦੇ ਹੋਏ ਸੁਣਿਆ ਜਾਵੇ ਅਤੇ ਅੱਗੇ ਤੋਂ ਇਸ ਤਰ੍ਹਾਂ ਕਿਸੇ ਹੋਰ ਨਾਲ਼ ਵੀ ਨਾ ਹੋ ਸਕੇ ਸੋ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹੋਵਾਂਗਾ